ਵੈਸੇ ਤਾਂ ਅੱਜ ਕੱਲ੍ਹ ਟੀਵੀ ਪ੍ਰੋਗਰਾਮ ਬਹੁਤ ਸਾਰੇ ਆਉਂਦੇ ਹਨ ਪਰ ਸਭ ਤੋਂ ਜ਼ਿਆਦਾ ਜੋ ਲੋਕਾਂ ਦਾ ਮਨਪਸੰਦ ਪ੍ਰੋਗਰਾਮ ਹੈ ਉਹ ਹੈ ਬਿਗ ਬੋਸ ਬਿਗ ਬੋਸ ਹਰ ਸਾਲ ਇੱਕ ਨਵਾਂ ਸੀਜ਼ਨ ਲੈ ਕੇ ਆਉਂਦਾ ਹੈ ਹਰ ਕੋਈ ਇਹ ਉਤਾਵਲਾ ਹੁੰਦਾ ਹੈ ਕਿ ਇਹਨਾਂ ਨੂੰ ਕੀ ਟਾਸਕ ਦਿੱਤੇ ਜਾਣਗੇ ਔਰ ਉਹ ਕਿਸ ਤਰ੍ਹਾਂ ਪੂਰੇ ਕਰਨਗੇ ਔਰ ਉਹਨਾਂ ਦੇ ਵਿੱਚ ਕਿਵੇਂ ਕਿਵੇਂ ਦੇ ਜਿਹੜੀ ਭਾਸ਼ਾ ਹੈ ਉਸ ਦਾ ਪ੍ਰਯੋਗ ਕੀਤਾ ਜਾਵੇਗਾ ਸਤਾਰਵਾਂ ਅਠਾਰਵਾਂ ਸੀਜ਼ਨ ਚੱਲ ਰਿਹਾ ਹੈ ਬਿੱਗ ਬੋਸ ਦਾ ਔਰ ਸ ਸਿਰਫ ਔਰ ਸਿਰਫ ਭਾਰਤ ਦੇ ਲੋਕ ਹੀ ਨਹੀਂ ਪੂਰੀ ਦੁਨੀਆਂ ਦੇ ਲੋਕ ਇਸ ਪ੍ਰੋਗਰਾਮ ਨੂੰ ਬੜੀ ਉਤਸੁਕਤਾ ਦੇ ਨਾਲ ਦੇਖਦੇ ਹਨ ਕੁਛ ਕੰਟੈਸਟੈਂਟ ਹੁੰਦੇ ਹਨ ਕਦੇ ਫਿਲਮੀ ਜਗਤ ਦੇ ਹੁੰਦੇ ਹਨ ਕੁਛ ਟੀਵੀ ਜਗਤ ਦੇ ਹੁੰਦੇ ਹਨ ਅੱਜ ਕੱਲ੍ਹ ਯੂਟਿਊਬਰ ਵੀ ਹੁੰਦੇ ਨੇ ਕੁਛ ਬਾਹਰ ਦੇ ਲੋਕ ਹੁੰਦੇ ਹਨ ਇਹਨਾਂ ਨੂੰ ਆਪਸ ਦੇ ਵਿੱਚ ਇੱਕ ਵੱਡੇ ਸਾਰੇ ਘਰ ਦੇ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਕਿ ਇਹਨਾਂ ਨੂੰ ਤਿੰਨ ਤੋਂ ਚਾਰ ਮਹੀਨੇ ਬਿਨਾਂ ਕਿਸੇ ਫੋਨ ਬਿਨਾਂ ਕਿਸੇ ਟੀਵੀ ਬਾਹਰਲੀ ਦੁਨੀਆਂ ਤੋਂ ਇਹਨਾਂ ਦਾ ਬਿਲਕੁਲ ਕੰਟੈਕਟ ਕੱਟ ਦਿੱਤਾ ਜਾਂਦਾ ਹੈ ਇਹਨਾਂ ਨੂੰ ਕੋਈ ਮੇਕਅਪ ਦਾ ਸਮਾਨ ਨਹੀਂ ਇਹਨਾਂ ਨੂੰ ਲਿਮਿਟਿਡ ਖਾਣ ਲਈ ਦਿੱਤਾ ਜਾਂਦਾ ਹੈ ਇਹਨਾਂ ਨੂੰ ਟਾਸਕ ਦਿੱਤੇ ਜਾਂਦੇ ਹਨ ਇਹਨਾਂ ਨੇ ਉਹ ਟਾਸਕ ਪੂਰੇ ਕਰਨੇ ਹੁੰਦੇ ਹਨ ਉਹ ਟਾਸਕ ਕੰਪਲੀਟ ਕਰਨ 'ਤੇ ਹੀ ਇਹਨਾਂ ਨੂੰ ਕੁਛ ਨਾ ਕੁਛ ਖਾਣ ਲਈ ਦਿੱਤਾ ਜਾਂਦਾ ਹੈ ਕੁਛ ਨਵੀਂ ਚੀਜ਼ ਦਿੱਤੀ ਜਾਂਦੀ ਹੈ ਇਹਨਾਂ ਨੂੰ ਅੱਗੇ ਵਧਣ ਦਿੱਤਾ ਜਾਂਦਾ ਹੈ ਇਹਦੇ ਵਿੱਚ ਕੈਪਟਨ ਬਣਾਇਆ ਜਾਂਦਾ ਹੈ ਉਹ ਦਾ ਕੰਮ ਹੈ ਕਿ ਸਾਰਿਆਂ ਨੂੰ ਅੱਗੇ ਲੈ ਕੇ ਚੱਲਣਾ ਦੋ ਟੀਮਾਂ ਬਣਾ ਦਿੱਤੀਆਂ ਜਾਂਦੀਆਂ ਹਨ ਉਹ ਆਪਣੇ ਟਾਸਕ ਕੰਪਲੀਟ ਕਰਦੀਆਂ ਹਨ ਦੂਸਰੀ ਟੀਮ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੂਸ ਜਿਹੜੀ ਔਪੋਜਿਟ ਟੀਮ ਹੈ ਉਹਨਾਂ ਦੀ ਉਸਨੂੰ ਇਹ ਟਾਸਕ ਕੰਪਲੀਟ ਨਾ ਕੀਤ ਕਰਨ ਦਿੱਤਾ ਜਾਵੇ ਇਹ ਟਾਸਕ ਕਰਦਿਆ ਕਰਦਿਆਂ ਕਈ ਵਾਰੀ ਲੜਾਈ ਵੀ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਬਹੁਤ ਹੀ ਮਾੜੀ ਤੋਂ ਮਾੜੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਗਾਲੀ ਗਲੋਚ 'ਤੇ ਵੀ ਉਤਰ ਆਉਂਦੇ ਹਨ ਪਰ ਇਹੀ ਚੀਜ਼ ਹੈ ਜੋ ਕਿ ਇਸ ਪ੍ਰੋਗਰਾਮ ਦੀ ਟੀ ਆਰ ਪੀ ਵਧਾਉਂਦੀ ਹੈ ਔਰ ਇਸ ਪ੍ਰੋਗਰਾਮ ਨੂੰ ਲੋਕਾਂ ਦੇ ਵਿੱਚ ਬਹੁਤ ਹੀ ਮਨ ਭਾਉਂਦਾ ਬਣਾਉਂਦੀ ਹੈ ਲੋਕ ਇਸ ਨੂੰ ਬੜੀ ਉਤਸੁਕਤਾ ਦੇ ਨਾਲ ਦੇਖਦੇ ਹਨ ਅਤੇ ਫਾਈਨਲੀ ਜੋ ਜਿੱਤਦਾ ਹੈ ਉਸ ਨੂੰ ਕਰੋੜਾਂ ਰੁਪਏ ਮਿਲਦੇ ਹਨ ਔਰ ਸਾਨੂੰ ਐਂਟਰਟੇਨਮੈਂਟ ਧੰਨਵਾਦ